ਪਿੰਡਾਂ ਵਿੱਚ ਕੋਚਿੰਗ ਸੰਸਥਾ ਨਾ ਹੋਣ ਕਰਕੇ ਪਿੰਡਾਂ ਦੇ ਬੱਚਿਆਂ ਨੂੰ ਡਾਂਸ ਸਿੱਖਣ ਲਈ ਬਾਹਰ ਜਾਣਾ ਪੈਂਦਾ ਹੈ ਜਿਸ ਵਿੱਚ ਕਿ ਕੁੜੀਆਂ ਵੀ ਡਾਂਸ ਕਰਨ ਦੇ ਸ਼ੌਂਕ ਰੱਖਦੀਆਂ ਨੇ ਪਰੰਤੂ ਪਿੰਡਾਂ ਦੇ ਲੋਕ ਕੁੜੀਆਂ ਨੂੰ ਡਾਂਸ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਅਤੇ ਇਸ ਲਈ ਪਿੰਡਾਂ ਵਿੱਚ ਕਈ ਪਿੰਡਾਂ ਵਿੱਚ ਤਾਂ ਬਿਜਲੀ ਦਾ ਪ੍ਰਬੰਧ ਵੀ ਵਧੀਆ ਨਹੀਂ ਹੈਗਾ ਉਸ ਕਾਰਨ ਵੀ ਡਾਂਸ ਕਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ ਬੱਚੇ ਅਪ ਬੱਚੇ ਬੱਚਿਆਂ ਨੂੰ ਦੇਖ ਕੇ ਡਾਂਸ ਕਰਨਾ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖਦੇ ਨੇ ਅਤੇ ਪਿੰਡ ਵਿੱਚ ਇਹੋ ਜਿਹਾ ਕੋਈ ਵੀ ਮਾਹੌਲ ਨਹੀਂ ਹੁੰਦਾ ਕਿ ਬੱਚੇ ਵਧੀਆ ਤਰੀਕੇ ਨਾਲ ਡਾਂਸ ਕਰਨਾ ਸਿੱਖ ਜਾਣ ਉਨ੍ਹਾਂ ਦੀ ਕਲਾ ਜਿਹੜੀ ਹੈ ਅ ਦਬ ਵਿੱਚ ਹੀ ਦਬੀ ਰਹਿ ਜਾਂਦੀ ਹੈ ਇਸ ਲਈ ਉਨ੍ਹਾਂ ਨੂੰ ਜੇ ਕੋਈ ਬੱਚਿਆਂ ਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ ਤਾਂ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਫੀਸਾਂ ਲਈਆਂ ਜਾਂਦੀਆਂ ਨੇ ਇੱਕ ਤਾਂ ਉਹ ਟਰੈਵਲ ਕਰਕੇ ਜਾਂਦੇ ਨੇ ਟਰੈਵਲ ਕਰਨ ਦੇ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਥਕਾਵਟ ਹੋ ਜਾਂਦੀ ਹੈ ਉਹ ਅੱਧੀ ਐਨਰਜੀ ਰਸਤੇ ਵਿੱਚ ਵੇਸਟ ਕਰ ਲੈਂਦੇ ਨੇ ਅੱਧੇ ਨਾਲੋਂ ਜ਼ਿਆਦਾ ਜੇ ਉਨ੍ਹਾਂ ਨੂੰ ਫੈਸਿਲਟੀਸ ਘਰ ਹੀ ਮਿਲ ਜਾਣਗੀਆਂ ਪਿੰਡ ਵਿੱਚ ਮਿਲ ਜਾਣਗੀਆਂ ਤਾਂ ਉਹ ਵਧੀਆ ਤਰੀਕੇ ਨਾਲ ਡਾਂਸ ਸਿੱਖਣਗੇ ਵਧੀਆ ਐਨਰਜੀ ਉਨ੍ਹਾਂ ਦੀ ਹੋਵੇਗੀ ਅਤੇ ਘੱਟ ਫੀਸਾਂ 'ਤੇ ਉਨ੍ਹਾਂ ਨੂੰ ਵਧੀਆ ਡਾਂਸ ਸਿੱਖਣ ਨੂੰ ਮਿਲੇਗਾ ਤਾਂ ਉਹ ਬੱਚੇ ਜਿਹੜੇ ਕਿ ਪਿੰਡ ਦੇ ਲੋਕ ਨੇ ਜਾਂ ਪਿੰਡ ਦੇ ਬੱਚੇ ਨੇ ਉਨ੍ਹਾਂ ਦਾ ਬਾਹਰ ਵੀ ਨਾਮ ਹੋਵੇਗਾ ਵਧੀਆ ਅੱਗੇ ਜਾ ਕੇ ਡਾਂਸਰ ਬਣਨਗੇ ਅਤੇ ਡਾ ਪਿੰਡ ਦਾ ਨਾਮ ਰੋਸ਼ਨ ਕਰਨਗੇ ਅ ਬੱਚਿਆਂ ਨੂੰ ਪਿੰਡਾਂ ਵਾਲੇ ਲੋਕਾਂ ਨੂੰ ਡਾਂਸ ਦੇ ਫਾਇਦੇ ਦੱਸ ਕੇ ਉਨ੍ਹਾਂ ਨੂੰ ਥੋੜ੍ਹਾ ਦੱਸਿਆ ਜਾਵੇ ਕਿ ਡਾਂਸ ਦੇ ਕੀ ਕੀ ਫਾਇਦੇ ਨੇ ਤਾਂ ਫਿਰ ਜਿਹੜੇ ਪਿੰਡ ਦੇ ਲੋਕ ਨੇ ਉਹ ਡਾਂਸ ਨੂੰ ਸਹੀ ਮੰਨਣਗੇ ਅਤੇ ਬੱਚਿਆਂ ਨੂੰ ਡਾਂਸ ਕਰਨ ਦੇਣਗੇ ਜੇ ਬੱਚੇ ਕੁਛ ਬੱਚੇ ਘਰੋਂ ਨਿਕਲਦੇ ਵੀ ਨੇ ਅਤੇ ਪਰ ਉਨ੍ਹਾਂ ਨੂੰ ਕਿਸੇ ਜਿਹੜੀਆਂ ਕੀ ਹੈ ਸੰਸਥਾਵਾਂ ਕੋਚਿੰਗ ਸੰਸਥਾਵਾਂ ਦੀ ਘਾਟ ਹੋਣ ਕਰਕੇ ਉਨ੍ਹਾਂ ਨੂੰ ਬਹੁਤ ਹੀ ਦਿੱਕਤਾਂ ਆਉਂਦੀਆਂ ਨੇ ਅਤੇ ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਵਧੀਆ ਅ ਜਿਹੜੇ ਕਿ ਦੂਰ ਪਿੰਡ ਹੈਗੇ ਹੈ ਬੋਡਰ ਲਾਈਨ ਤੋਂ ਦੂਰ ਨੇ ਬਾਹਰ ਨੇ ਉੱਥੇ ਕੋਚਿੰਗ ਸੈਂਟਰ ਖੋਲ੍ਹੇ ਜਾਣ ਜਿੱਥੇ ਬਿਜਲੀ ਦੀ ਵੀ ਥੋੜ੍ਹੀ ਵਧੀਆ ਫਸਿਲਟੀਜ ਹੋਵੇ ਅਤੇ ਵਧੀਆ ਤਰੀਕੇ ਨਾਲ ਬੱਚੇ ਡਾਂਸ ਸਿੱਖ ਸਕਣ ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਜਾਣ ਥੋੜ੍ਹੀਆਂ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਬੱਚੇ ਥੋੜ੍ਹਾ ਡਾਇ ਡਾਂਸ ਕਰਨਗੇ ਤਾਂ ਉਹ ਸਰੀਰਕ ਪੱਖੋਂ ਵੀ ਤੰਦਰੁਸਤ ਰਹਿਣਗੇ ਉਨ੍ਹਾਂ ਦਾ ਦਿਮਾਗ ਵੀ ਤਾਜ਼ਾ ਰਹੇਗਾ ਤੇ ਅਤੇ ਬੱਚੇ ਦਾ ਬੁਰਿਆਂ ਵਿਚਾਰਾਂ ਤੋਂ ਵੀ ਬਚਣਗੇ ਉਸ ਨਾਲ ਉਨ੍ਹਾਂ ਦਾ ਮਨ ਵੀ ਜਿਹੜਾ ਕੀ ਹੈ ਸ਼ਾਂਤ ਰਹੇਗਾ ਅਤੇ ਉਨ੍ਹਾਂ ਦਾ ਮੋਬਾਈਲ ਤੋਂ ਧਿਆਨ ਵੀ ਹੱਟਿਆ ਰਹੇਗਾ